ਇਸ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਹੁਣ ਵਾਲੀ ਪੀੜ੍ਹੀ ਜਿਹੜੀ ਛੋਟੀਆਂ ਪੀੜ੍ਹੀਆਂ ਇਹਨਾਂ ਨਾਲ਼ੋਂ ਜਿਹੜੀ ਪੁਰਾਣੀਆਂ ਪੀੜ੍ਹੀਆਂ ਸੀ ਉਹ ਜ਼ਿਆਦਾ ਧਾਰਮਿਕ ਸੀ ਦੇਖੋ ਜਿਹੜੇ ਪੁਰਾਣੇ ਸਾਡੇ ਲੋਕ ਸੀ ਬਜ਼ੁਰਗ ਲੋਕ ਆ ਉਹ ਜ਼ਿਆਦਾ ਧਾਰਮਿਕ ਗ੍ਰੰਥ ਪੜ੍ਹਦੇ ਰਹਿੰਦੇ ਸਨ ਜਾਂ ਧਾਰਮਿਕ ਕਥਾਵਾਂ ਸੁਣਦੇ ਰਹਿੰਦੇ ਸਨ ਜਿਹੜੇ ਲੋਕ ਪੜ੍ਹ ਨਹੀਂ ਸੀ ਸਕਦੇ ਉਹ ਕਹਾਣੀਆਂ ਕਥਾਵਾਂ ਸੁਣਦੇ ਸਨ ਲੋਕ ਗੁਰਦੁਆਰਿਆਂ ਵਿੱਚ ਮੰਦਰਾਂ ਵਿੱਚ ਜਾ ਕੇ ਆਪਣੇ ਸੰਤਾਂ ਦੀਆਂ ਮਹਾਂਪੁਰਖਾਂ ਦੀਆਂ ਬਾਣੀ ਸੁਣਦੇ ਸੀ ਉਹਨਾਂ ਦੇ ਕੋਲੋਂ ਪੰਡਤਾਂ ਕੋਲੋਂ ਜਾਂ ਗੁਰਦੁਆਰੇ ਵਿੱਚ ਗ੍ਰੰਥੀ ਸਿੰਘ ਹੁੰਦਾ ਸੀ ਉਹਨਾਂ ਦੇ ਕੋਲੋਂ ਅਤੇ ਉਹਨਾਂ ਦਰ ਜ਼ਿਆਦਾਤਰ ਉਹਨਾਂ ਦੀਆਂ ਕਥਾਵਾਂ ਸੁਣਦੇ ਸੀ ਜਿਹੜੇ ਯੋਧੇ ਹੋਏ ਸਾਡੇ ਉਹਨਾਂ ਦੀਆਂ ਜਿੱਦਾਂ ਬਾਬਾ ਬੰਦਾ ਸਿੰਘ ਬਹਾਦਰ ਮਤੀਦਾਸ ਭਾਈ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਆ ਇਹ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਥ ਆਪਣੇ ਹੱਥ ਨਾਲ਼ ਲਿਖਿਆ ਉਹਨਾਂ ਦੇ ਲੋਕ ਜਿਹੜੇ ਸੀ ਉਹ ਲੋਕ ਸੀ ਉਹ ਜ਼ਿਆਦਾਤਰ ਧਾਰਮਿਕ ਬਿਰਤੀ ਵਾਲੇ ਸੀ ਅਤੇ ਧਾਰਮਿਕ ਗੱਲਾਂ ਕਰਦੇ ਸੀ ਜਦੋਂ ਵੀ ਕਿਤੇ ਬੈਠਦੇ ਸੀ ਕਿਤੇ ਵਿਆਹ ਸਮਾਗਮ ਦੇ 'ਚ ਵੀ ਬੈਠਦੇ ਸੀ ਤਾਂ ਜ਼ਿਆਦਾ ਧਾਰਮਿਕ ਗੱਲਾਂ ਹੀ ਕਰਦੇ ਸੀ ਹੁਣ ਦੇ ਜਿਹੜੇ ਲੋਕ ਆ ਜਿਹੜੀ ਨਵੀਂ ਪੀੜ੍ਹੀ ਆ ਛੋਟੀਆਂ ਪੀੜ੍ਹੀਆਂ ਇਹ ਜ਼ਿਆਦਾਤਰ ਅੱਜ ਕੱਲ੍ਹ ਨੈੱਟ ਦਾ ਸਿਸਟਮ ਹੋਣ ਕਰਕੇ ਨੈੱਟ ਦੇ ਨਾਲ਼ ਜੁੜੇ ਆ ਜ਼ਿਆਦਾਤਰ ਆਪਣੇ ਧਾਰਮਿਕ ਪੱਖੋਂ ਗੁਰੂ ਘਰਾਂ ਪੱਖੋਂ ਜਿਹੜੇ ਉਹ ਟੁੱਟਦੇ ਜਾਂਦੇ ਆ ਬਹੁਤ ਘੱਟ ਮਾਤਰਾ 'ਚ ਜਾਂਦੇ ਆ ਜਾਂ ਬਿਲਕੁਲ ਫਾਰਮੈਲਟੀ ਪੂਰੀ ਕਰਦੇ ਆ ਬਸ ਵੀ ਅਸੀਂ ਜਾਣ ਡੇ ਗੁਰਦੁਆਰੇ ਸਾਹਿਬ ਗਏ ਹਾਂ ਅਸੀਂ ਮੰਦਰ 'ਚ ਗਏ ਅਸੀਂ ਮਸਜਿਦ ਗਏ ਹਾਂ ਪਰ ਜਿਹੜੀਆਂ ਪੁਰਾਣੀਆਂ ਪੀੜ੍ਹੀਆਂ ਸੀ ਉਹ ਸ਼ਰਧਾ ਨਾਲ਼ ਪੂਰਾ ਪੂਰਾ ਦਿਨ ਕੋਈ ਸਮਾਗਮ ਹੁੰਦਾ ਸੀ ਤਾਂ ਗੁਰਦੁਆਰੇ ਰਹਿੰਦੇ ਸੀ ਉਚੇਚੇ ਤੌਰ 'ਤੇ ਜਾਂਦੇ ਸੀ ਗੁਰਦੁਆਰੇ 'ਚ ਮੰਦਰ 'ਚ ਸਾਰੇ ਆਪਣੇ ਸੱਭਿਆਚਾਰਕ ਮੇਲੇ ਮਨਾਉਂਦੇ ਸੀਗੇ ਪਰ ਜਿਹੜੀਆਂ ਛੋਟੀਆਂ ਪੀੜ੍ਹੀਆਂ ਨਵੀਆਂ ਪੀੜ੍ਹੀਆਂ ਵਾ ਇਹ ਜ਼ਿਆਦਾਤਰ ਆਪਣਾ ਜਿਹੜਾ ਫ਼ੋਨ ਫ਼ੋਨਾਂ ਦੇ ਉੱਤੇ ਜਾਂ ਆਪਣੇ ਉਹ ਫੇਸਬੁੱਕ ਔਨਲਾਈਨ ਸਿਸਟਮ ਜਿਹੜਾ ਇੱਧਰ ਨੂੰ ਜ਼ਿਆਦਾ ਤਰਜੀਹ ਦਿੰਦੀਆਂ ਵਾਂ ਅਤੇ ਆਪਣੇ ਧਾਰਮਿਕ ਗ੍ਰੰਥਾਂ ਨਾਲ਼ੋਂ ਧਾਰਮਿਕ ਨਾਲ਼ੋਂ ਟੁੱਟਦੀਆਂ ਜਾਂਦੀਆਂ